ਹੈਲੋ ਹਾਂਜੀ ਹਾਂਜੀ ਹਾਂਜੀ ਅੱਛਾ ਤੁਸੀਂ ਟਰਾਈ ਨਹੀਂ ਕੀਤਾ ਜਦੋਂ ਲੈ ਗਏ ਸੀ ਹਾਂਜੀ ਅੱਛਾ ਕੋਈ ਨਾ ਆ ਜਿਓ ਐਕਸਚੇਂਜ ਕਰ ਦਾਂਗੇ ਹਾਂਜੀ ਕੋਈ ਨਾ ਭਾਵੇਂ ਅੱਜ ਆ ਜਿਓ ਕੋਈ ਚੱਕਰ ਨਹੀਂ ਨਾ ਫਿਰ ਉਹ ਨਹੀਂ ਉਹ ਤੁਹਾਨੂੰ ਚਾ ਮਤਲਬ ਜ਼ਿਆਦਾ ਚਾਰਜ ਕਰਨੇ ਪੈਣੇ ਨੇ ਬਾਕੀ ਹੋਰ ਤਾਂ ਕੋਈ ਨਹੀਂ ਕੋਈ ਨਾ ਤੁਸੀਂ ਆਏ ਜੀ ਕਰ ਲਵਾਂਗੇ ਬਾਕੀ ਫਿਰ ਵੀ ਸਾਡਾ ਜੋ ਸਾਡਾ ਫਿਕਸ ਰੇਟ ਹੈ ਜਾਂ ਕੁਛ ਹੈ ਸਾਨੂੰ ਆਦੇ ਉਸ ਹਿਸਾਬ ਨਾਲ ਚੱਲਣਾ ਪੈਂਦਾ ਫਿਰ ਬਾਕੀ ਕਸਟਮਰ ਆ ਕੇ ਬੋਲਦੇ ਨੇ ਸਾਨੂੰ ਤੁਸੀਂ ਉਹਨਾਂ ਨਾਲ ਤਾਂ ਐਵੇਂ ਕੀਤਾ ਸਾਡੇ ਨਾਲ ਐਵੇਂ ਨਹੀਂ ਕਰੀ ਜਾਂਦੇ ਫਿਰ ਉਹ ਹਿਸਾਬ ਨਾਲ ਸਾਨੂੰ ਚੱਲਣਾ ਪੈਂਦਾ ਹੈ ਨਾ ਬਾਕੀ ਤੁਸੀਂ ਆ ਜਾਓ ਥੋੜ੍ਹਾ ਜਿਹਾ ਜ਼ਿਆਦਾ ਚਾਰਜ ਲੱਗਣਗੇ ਫਿਰ ਕੀ ਹੈ ਤੁਹਾਡੀ ਮਨਪਸੰਦ ਚੀਜ਼ 'ਚ ਜੋ ਐਕਸਚੇਂਜ ਕਰਕੇ ਦਿੰਦੇ ਪਏ ਹਾਂ ਇਹ ਤਾਂ ਤੁਸੀਂ ਇੰਨੀ ਦੂਰ ਭੇਜਿਆ ਉਹ ਟਰਾਈ ਕੀਤਾ ਫਿਰ ਤੁਸੀਂ ਸਾਨੂੰ ਵਾਪਸ ਦੇ ਜਾਂਦੇ ਹੋ ਫਿਰ ਵੀ ਅਸੀਂ ਐਕਸਚੇਂਜ ਕਰੀ ਜਾਂਦੇ ਹਾਂ ਨਾ ਤੁਸੀਂ ਕਮ ਸੇ ਕਮ ਦੋ ਦਿਨ ਪਹਿਲਾਂ ਚੀਜ਼ ਖਰੀਦੀ ਦਾ ਦੋ ਦਿਨ ਰੱਖਿਆ ਫਿਰ ਵੀ ਵੇਖ ਤੁ ਤੁਹਾਡੀ ਐਕਸਚੇਂਜ ਜੀ ਕਰੀ ਜਾਂਦੇ ਹਾਂ ਅਸੀਂ ਹਾਂਜੀ ਜੇ ਕੁਝ ਹੋਰ ਲੈਣਾ ਉਹ ਵੀ ਲੈ ਸਕਦੇ ਹੋ ਨਵੀਂ ਕੁਆਲਿਟੀ ਦੇ ਨਵੇਂ ਵੂਲ ਵਾਲੇ ਜਰਸੀਆਂ ਸਵੈਂਟਰ ਸਭ ਤਰ੍ਹਾਂ ਦੇ ਆਏ ਹੋਏ ਨੇ ਹਾਂ ਫਿਰ ਉਹ ਹਿਸਾਬ ਨਾਲ ਡਿਸਕਾਉਂਟ ਦੇ ਦੇਵਾਂਗੇ ਕੋਈ ਆਸ ਪਾਸ ਦੇ ਲੋਕ ਹੋਣ ਉਹਨਾਂ ਨੂੰ ਵੀ ਕਹਿ ਦਿਆ ਜੇ ਨਵੀਂ ਕੁਆਲਿਟੀ ਦੇ ਕੱਪੜੇ ਨਵੇਂ ਸਭ ਤਰ੍ਹਾਂ ਦੇ ਆਏ ਨੇ ਉਹ ਵੀ ਵਿੰਟਰ ਦੇ ਜਿਨੇ ਲੈ ਲੈਣ ਦੇ ਇਛੁੱਕ ਹੋਣ ਲੈ ਸਕਦੇ ਨੇ ਪਲੀਜ਼ ਜਲਦੀ ਰਹੰਦ ਉਹ ਐਕਸਚੇਂਜ ਜਿਹੜਾ ਕਰਵਾਉਣਾ ਹੈ ਨਾ ਤਾਂ ਜਾਂ ਤਾਂ ਅੱਜ ਆਇਓ ਜਾਂ ਕੱਲ੍ਹ ਤੱਕ ਉਹ ਕੀ ਪਹਿਲਾਂ ਵੀ ਤੁਸੀਂ ਦੋ ਦਿਨ ਤਿੰਨ ਦਿਨ ਰੱਖ ਚੁੱਕੇ ਹੋ ਫਿਰ ਹੁਣ ਤੁਸੀਂ ਆਈ ਜਾਂਦੇ ਹੋ ਫਿਰ ਇੰਨੀ ਲੇਟ ਨਹੀਂ ਅਸੀਂ ਕਰਨੇ ਹੋ ਸਕੇ ਤਾਂ ਅੱਜ ਆਇਓ ਠੀਕ ਹੈ ਜਲਦੀ ਤੋਂ ਜਲਦੀ ਓਕੇ ਓਕੇ ਠੀਕ